ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਇਹ ਫਰਕ ਹੈ ਕਿ ਪੁਰਾਣੇ ਗੀਤ ਰਾਗ ਰਾਗੜੀਆਂ ਮਿੱਠੀ ਮੈਲੋਡੀ ਸੁਧਾਰਨ ਯੰਤਰ ਜਿਵੇਂ ਹਰਮੋਨੀਅਮ ਤਬਲਾ ਸਿਤਾਰ 'ਤੇ ਧੁਨੀਆਂ ਬਣੀਆਂ ਹੁੰਦੀਆਂ ਸਨ ਅਤੇ ਅੱਜ ਦੇ ਗੀਤ ਜਿਵੇਂ ਮੋਡਰਨ ਬੀਨਸ ਡੀ ਜੇ ਮਿਕਸਿੰਗ ਅਤੇ ਮਸ਼ੀਨੀ ਆਵਾਜ਼ਾਂ ਜ਼ਿਆਦਾ ਹੁੰਦੀਆਂ ਹਨ ਅਸੀਂ ਬੋਲ ਅਤੇ ਕਥਾ ਦੀ ਗੱਲ ਕਰੀਏ ਤਾਂ ਪੁਰਾਣੇ ਗੀਤ ਭਾਵਨਾਤਮਿਕ ਕਵਿਤਾਮਈ ਅਤੇ ਜ਼ਿੰਦਗੀ ਪਿਆਰ ਵਿਛੋੜੇ ਰੂਹਾਨੀਅਤ 'ਤੇ ਅਧਾਰਿਤ ਹੁੰਦੇ ਸਨ ਅਤੇ ਅੱਜ ਦੇ ਗੀਤ ਆਮ ਤੌਰ 'ਤੇ ਜਿਵੇਂ ਮੌਜ ਮਸਤੀ ਹੋ ਗਈ ਪਾਰਟੀ ਗੱਡੀਆਂ ਸ਼ੌਂਕ ਅਤੇ ਬੋਲਡ ਟੋਪਿਕ 'ਤੇ ਲੱਗੇ ਹੁੰਦੇ ਆਵਾਜ਼ ਅਤੇ ਗਾਇਕੀ ਦੀ ਗੱਲ ਕਰੀਏ ਤਾਂ ਪੁਰਾਣੇ ਗੀਤ ਗਾਇਕ ਵ ਦੀ ਸ਼ੁੱਧ ਆਵਾਜ਼ ਜਿਵੇਂ ਕਲਾਸੀਕਲ ਤਾਲੀਮ 'ਤੇ ਅਧਾਰਿਤ ਗਾਇਕੀ ਅਤੇ ਧਿਆਨ ਦਿੰਦੀ ਸੀ ਅੱਜ ਦੇ ਗੀਤਾਂ ਦੀ ਗੱਲ ਕਰੀਏ ਤਾਂ ਆਵਾਜ਼ ਨੂੰ ਆਟੋ ਟਿਊਨ ਨਾਲ ਸੋਧਿਆ ਜਾਂਦਾ ਹੈ ਗਾਇਕਾਂ ਦੀ ਗਾਇਕੀ ਵਿੱਚ ਤੇਜ਼ ਰਿਦਮ ਅਤੇ ਭਾਵਸ਼ੈਲੀ ਜ਼ਿਆਦਾ ਹੁੰਦੀ ਹੈ ਮੂਡ 'ਤੇ ਅਸਰ ਦੀ ਗੱਲ ਕਰੀਏ ਤਾਂ ਪੁਰਾਣੇ ਗੀਤ ਦਿਲ ਨੂੰ ਛੂਹਣ ਵਾਲੇ ਯਾਦਗਾਰ ਅਤੇ ਹਮੇਸ਼ਾ ਲਈ ਰਹਿਣ ਵਾਲੇ ਹੁੰਦੇ ਸਨ ਅਤੇ ਅੱਜ ਦੇ ਗੀਤਾਂ ਦੀ ਗੱਲ ਕਰੀਏ ਤਾਂ ਫੈਸ਼ਨ ਅਨੁਸਾਰ ਬਦਲਦੇ ਹਨ ਕੁਝ ਸਮੇਂ ਬਾਅਦ ਭੁੱਲ ਜਾਂਦੇ ਸਨ ਮੈਨੂੰ ਬਹੁਤ ਜ਼ਿਆਦਾ ਪਸੰਦ ਜਿਹੜੇ ਗੀਤ ਹੈ ਉਹ ਹੈ ਪੁਰਾਣੇ ਗੀਤ ਜੇਕਰ ਦਿਲ ਨੂੰ ਵਾਲੇ ਸ਼ਬਦ ਅਤੇ ਮਿਠੜੀ ਧੁੰਨ ਦੀ ਗੱਲ ਕਰੀਏ ਤਾਂ ਪੁਰਾਣੇ ਗੀਤ ਹੀ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਹੈ ਪਰ ਜੇਕਰ ਮੌਸ ਮੌਜ ਮਸਤੀ ਅਤੇ ਨੱਚਣ ਵਾਲੇ ਗੀਤ ਚਾਹੁੰਦੇ ਹਨ ਤਾਂ ਅੱਜ ਦੇ ਗੀਤ ਵੀ ਆਪਣੇ ਢੰਗ ਨਾਲ ਵਧੀਆ ਹੀ ਹੈ